ਹਾਂਜੀ ਹੈਲੋ ਹਾਂਜੀ ਅਮਨ ਬੋਲ ਰਿਹਾ ਸੀ ਜੀ ਹਾਂਜੀ ਫੋਟੋਗ੍ਰਾਫੀ ਸਟੂਡੀਓ ਬੋਲ ਰਹੇ ਓ ਜੀ ਹਾਂਜੀ ਆਪਣੇ ਮੈਰਿਜ ਸੀਗੀ ਛੋਟੇ ਬ੍ਰਦਰ ਦੀ ਹਾਂਜੀ ਓਹਦੇ ਵਾਸਤੇ ਪਤਾ ਕਰਨਾ ਸੀ ਨਾਲ ਜਾਗੋ ਦਾ ਪ੍ਰੋਗਰਾਮ ਹੈ ਜੀ ਹਾਂਜੀ ਹਾਂਜੀ ਨਾਲ ਪੀ ਲੈਣੀ ਹੈ ਵੀ ਤੁਹਾਨੂੰ ਕਿਸ ਤਰ੍ਹਾਂ ਕਿੰਨੇ ਕੁ ਪੈਸਿਆਂ 'ਚ ਲੋਟ ਆਊਗਾ ਵੀਡੀਓ ਦਾ ਕੀ ਹਿਸਾਬ ਕਿਤਾਬ ਹੋਊਗਾ ਅਤੇ ਫੋਟੋਆਂ ਦਾ ਕੀ ਐਲਬਮ ਦਾ ਕੀ ਰੇਟ ਪਊਗਾ ਜੀ ਹਾਂਜੀ ਹਾਂਜੀ ਐਲਬਮ ਫੋਟੋ ਵਾਲੀ ਹਾਂਜੀ ਹਾਂਜੀ ਇੱਕ ਆਪਾਂ ਨੂੰ ਬੈਂਸ ਦੇ ਚਿਹਰਿਆਂ ਦੀ ਫੋਟੋਆਂ ਵੱਲੋਂ ਉਹ ਵੀ ਅਲੱਗ ਤੋਂ ਚਾਹੀਦੀਆਂ ਨੇਗੀਆਂ ਆਰਕੈਸਟਰਾ ਨੂੰ ਬੁਲਾਉਣ ਵਾਸਤੇ ਮੈਰਿਜ ਵਾਲਿਆਂ ਨੂੰ ਫੋਟੋਆਂ ਵੀ ਲਾਉਣੀਆਂ ਪੈਣਗੀਆਂ ਨਾ ਹਾਂਜੀ ਠੀਕ ਹੈ ਠੀਕ ਹੈ ਜੀ

ਠੀਕ ਹੈ ਜੀ ਜਿਹੜਾ ਹੁਣ ਡੀਜੀਟਲ ਡੀਜੀਟਲ ਫੋਟੋਆਂ ਬਣਦੀਆਂ ਨੇਗੀਆਂ ਆਪਣੇ ਉਹ ਚੱਲਦੀਆਂ ਹੁਣ ਨਾ ਪੁਰਾਣੀਆਂ ਜਿਹੜੀਆਂ ਪਹਿਲਾਂ ਨਿਕਲਦੀਆਂ ਸੀ ਉਹ ਨਹੀਂ ਚੱਲਦੀਆਂ ਜਿੱਦਾਂ ਇਹ ਇਹ ਇੱਕ ਜੀ ਇੱਕ ਇਹਦੇ ਵਿੱਚ ਨਾ ਪਹਿਲਾਂ ਆਪਾਂ ਇਹਨਾਂ ਨੂੰ ਖੋਲਦੇ ਆਂ ਜੀ ਉਹਦੇ ਵਿੱਚ ਭਰਨਾ ਆ ਜਾਂਦਾ ਵਿਚਾਲੇ ਇੱਕ ਬਲੋਟ ਭਰਣ ਵਾਲਾ ਹੁੰਦਾ ਇਹ 'ਚ ਆਪਾਂ ਨੂੰ ਮੈਨਿਉ ਕਿਹੜੇ ਕਿਹੜੀਆਂ ਕਿਹੜੀ ਚੀਜ਼ ਪੈਣੀ ਹੈ ਜੀ ਠੀਕ ਹੈ ਜੀ ਠੀਕ ਠੀਕ ਠੀਕ ਠੀਕ ਠੀਕ ਠੀਕ ਹੈ ਜੀ ਜਿਹੜੀਆਂ ਆਪਾਂ ਉਹ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਆਪਾਂ ਨੂੰ ਤਾਂ ਜਮ੍ਹਾ ਸਿੰਪਲ ਪੇਂਡੂ ਸੱਭਿਆਚਾਰ ਚਾਹੀਦਾ ਉਹ ਦੇਖ ਲੋ ਲੋਕੇਸ਼ਨ ਕਿੱਥੇ ਦੀ ਹੈ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਜਿਹੜੀਆਂ ਫੋਟੋਆਂ ਵਗੈਰਾ ਹੋਣੀਆਂ ਉੱਥੇ ਹੀ ਹੋਣਗੀਆਂ ਵੱਡੀਆਂ ਕਰਨ ਵਾਸਤੇ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਇਹ ਆਪਾਂ ਨੂੰ ਪੈਕੇਜ ਕਿੰਨੇ 'ਚ ਕਿੰਨੇ 'ਚ ਪੈਣਾ ਪੈਕੇਜ ਇਹ ਜੀ ਐਲਬਮ ਐਲਬਮਾਂ ਦੋ ਬਨਣਗੀਆਂ ਇੱਕ ਜਾਗੋ ਦੀ ਅਤੇ ਆਪਣੇ ਘਰ ਦੀ ਹੋ ਜਾਣੀ ਹੈ ਦੂਸਰੀ ਪੇਲੇਸ ਵਾਲੀ ਹੋ ਜਾਣੀ ਦੋ ਹੀ ਬਨਣਗੀਆਂ ਜੀ ਠੀਕ ਠੀਕ ਹੈ ਜੀ ਅਤੇ ਜਿਹੜੀ ਵੀਡੀਓ ਬਣਦੀ ਇਹ ਪਿੰਡ ਹੈ ਕੀ ਆ ਇਹ ਠੀਕ ਹੈ ਜੀ ਠੀਕ ਠੀਕ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹਦਾ ਕੀ ਹਿਸਾਬ ਹੁੰਦਾ ਜੀ ਵੀਡੀਓ ਦਾ ਘੰਟਿਆਂ ਦੇ ਹਿਸਾਬ ਨਾਲ ਹੁੰਦੀ ਹੈ ਕਿ ਪੂਰੇ ਵਿਆਹ ਦਾ ਪੈਕੇਜ 'ਚ ਹੀ ਆ ਜਾਂਦੀ ਹੈ ਠੀਕ ਹੈ ਜੀ ਕਿੰਨੇ 'ਚ ਪਊਗਾ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਠੀਕ ਹੈ ਜੀ

ਔਰ ਇੱਕ ਆਪਣਾ ਅਡਰੈੱਸ ਅਡਰੈੱਸ ਦੱਸੋ ਜੀ ਦੁਕਾਨ ਦਾ ਸ਼ੋਪ ਦਾ ਅਸੀਂ ਕੱਲ੍ਹ ਕੱਲ੍ਹ ਜਾਂ ਪਰਸੋਂ ਆਵਾਂਗੇ ਤੁਹਾਡੇ ਕੋਲ ਜੀ

ਠੀਕ ਹੈ ਜੀ ਠੀਕ ਹੈ ਸਰ ਠੀ ਠੀਕ ਠੀਕ ਹੈ ਸਰ ਠੀ

ਠੀਕ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਠੀਕ ਹੈ ਜੀ

ਠੀਕ ਹੈ ਥੈਂਕ ਯੂ ਜੀ